ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਤੋਂ ਚੰਡੀਗੜ੍ਹ ਸਤਾਰ੍ਹਾਂ ਸੈਕਟਰ ਬੱਸ ਸਟੈਂਡ ਤੱਕ ਜਾਣਾ ਹੈ ਮੇਰਾ ਪਿੰਡ ਸਤਾਰ੍ਹਾਂ ਸੈਕਟਰ ਤੋਂ ਪੰਦਰ੍ਹਾਂ ਕਿਲੋਮੀਟਰ ਦੂਰ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਨਕਦੀ ਰਾਹੀਂ ਭੁਗਤਾਨ ਕਰ ਸਕਦੇ ਹੋ ਜਾਂ ਔਨਲਾਈਨ ਭੁਗਤਾਨ ਕਰੋਗੇ